ਜੇਕਰ ਅਸੀਂ ਫੋਟੋਗ੍ਰਾਫੀ ਦੀ ਗੱਲ ਕੀਤੀ ਜਾਈਏ ਤਾਂ ਫੋਟੋਗ੍ਰਾਫੀ ਇੱਕ ਬੜੀ ਹੀ ਵਧੀਆ ਚੀਜ਼ ਹੈ ਫੋਟੋਗ੍ਰਾਫੀ ਨੇ ਤਾਂ ਅੱਜ ਕੱਲ੍ਹ ਵਾਹ ਵਾਹ ਹੀ ਕਰਾ ਦਿੱਤੀ ਪਈ ਹੈ ਜੇ ਗੱਲ ਕਰੀਏ ਫੋਟੋਗ੍ਰਾਫਰ ਦੀ ਫੋਟੋਗ੍ਰਾਫਰ ਨੂੰ ਤਾਂ ਅੱਜ ਕੱਲ੍ਹ ਬੜੀ ਹੀ ਅਹਿਮੀਅਤ ਦਿੱਤੀ ਜਾਂਦੀ ਹੈ ਲੋਕ ਅੱਜ ਕੱਲ੍ਹ ਹਰ ਥਾਂ 'ਤੇ ਕੋਈ ਫੰਕਸ਼ਨ ਹੋਵੇ ਘਰ 'ਚ ਕੋਈ ਵਿਆਹ ਹੋਵੇ ਹਰ ਥਾਂ 'ਤੇ ਫੋਟੋਗ੍ਰਾਫਰ ਮੌਜੂਦ ਕਰਵਾਉਂਦੇ ਹਨ ਫੋਟੋਗ੍ਰਾਫਰ ਫੋਟੋਆਂ ਖਿੱਚ ਖਿੱਚ ਕੇ ਉਸ ਨੂੰ ਇੱਕ ਯਾਦਗਾਰ ਚੀਜ਼ ਬਣਾ ਦਿੰਦਾ ਹੈ ਕੱਲ੍ਹ ਨੂੰ ਅਸੀਂ ਆਪਣੀ ਯਾਦਗਾਰ ਨੂੰ ਆਪਣੀ ਯਾਦਗਾਰ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਸਕਦੇ ਹਾਂ ਜੇਕਰ ਮੈਂ ਆਪਣੀ ਉਦਾਹਰਨ ਦੇਵਾ ਤਾਂ ਜਿਸ ਵੇਲੇ ਮੈਂ ਇੱਕ ਸਾਲ ਦੀ ਦੋ ਸਾਲ ਦੀ ਸੀ ਮੇਰੇ ਘਰਦਿਆਂ ਨੇ ਮੇਰਾ ਜਨਮ ਦਿਨ ਮਨਾਇਆ ਸੀ ਬੜੇ ਧੂਮ ਧਾਮ ਨਾਲ ਉਸ ਵੇਲੇ ਮੈਂ ਜੋ ਕਿ ਬੱਚੀ ਸੀ ਮੈਨੂੰ ਹੁਣ ਇਸ ਟੈਮ ਇਸ ਵੇਲੇ ਕੁਛ ਵੀ ਯਾਦ ਨਹੀਂ ਉਸ ਸਮੇਂ ਦਾ ਪਰ ਜੇਕਰ ਮੈਂ ਫੋਟੋਗ੍ਰਾਫਰ ਦੀ ਖਿੱਚੀਆਂ ਹੋਈਆਂ ਫੋਟੋਆਂ ਦੇਖਾਂ ਤਾਂ ਮੈਨੂੰ ਉਸ ਵੇਲੇ ਦੀਆ ਯਾਦਾਂ ਵੀ ਤਾਜ਼ੀਆਂ ਹੋ ਜਾਂਦੀਆਂ ਹਨ ਫੋਟੋਗ੍ਰਾਫਰ ਨੇ ਇੰਨਾ ਵਧੀਆ ਕੰਮ ਕਰ ਕੀਤਾ ਹੈ ਕਿ ਲੋਕਾਂ ਦੀ ਯਾਦਾਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ ਲੋਕ ਜਦੋਂ ਛੋਟੇ ਸੀਗੇ ਜਦੋਂ ਜਵਾਨ ਹੋਏ ਅੱਜ ਕੱਲ੍ਹ ਬੁੱਢੇ ਲੋਕ ਵੀ ਆਪਣੀ ਪੂਰੀ ਜ਼ਿੰਦਗੀ ਦਾ ਸਫ਼ਰ ਦੇਖ ਸਕਦੇ ਹਨ ਲੋਕ ਦੇਖਦੇ ਹਨ ਕਿ ਅਸੀਂ ਇਸ ਵੇਲੇ ਬੁੱਢੇ ਸੀਗੇ ਇਸ ਵੇਲੇ ਜਵਾਨ ਸੀਗੇ ਫੋਟੋਗ੍ਰਾਫੀ ਨੇ ਤਾਂ ਅੱਜ ਕੱਲ੍ਹ ਬਸ ਵਾਹ ਵਾਹ ਹੀ ਕਰਵਾ ਦਿੱਤੀ ਹੈ